ਪੱਚੀ ਅਗਸਤ ਉੱਨੀ ਸੌ ਬਿਆਸੀ ਸੱਤ ਜਨਵਰੀ ਉੱਨੀ ਸੌ ਬਾਨਵੇਂ ਗਿਆਰਾਂ ਸਤੰਬਰ ਦੋ ਹਜ਼ਾਰ ਅਠਾਰ੍ਹਾਂ ਦੋ ਜੁਲਾਈ ਦੋ ਹਜ਼ਾਰ ਵੀਹ ਪੰਜ ਅਪ੍ਰੈਲ ਦੋ ਹਜ਼ਾਰ ਇੱਕੀ